ਰਾਤ ਦਾ ਸਮੇਂ ਸੀ ਅਤੇ ਸਾਰੀਆਂ ਬੱਸਾਂ ਬੰਦ ਹੋ ਚੁੱਕੀਆਂ ਸੀ ਕੋਈ ਅੋਟੋ ਰਿਕਸ਼ਾ ਵੀ ਨਹੀਂ ਚੱਲ ਰਿਹਾ ਸੀ ਅਤੇ ਮੇਰੇ ਘਰਦਿਆਂ ਨੇ ਮੈਨੂੰ ਕੋਲ ਕੀਤਾ ਅਤੇ ਪੁੱਛਿਆ ਮੇਰੀ ਹਾਲਤ ਕੀ ਹੈ ਹਲੇ ਮੈਂ ਕਿੱਥੇ ਹੈਗਾ ਹਾਂ ਮੈਂ ਉਹਨਾਂ ਨੂੰ ਦੱਸਿਆ ਹੈ ਮੈਂ ਆਪਣੇ ਘਰ ਤੋਂ ਬਹੁਤ ਦੂਰ ਹੈਗਾ ਉਹਨਾਂ ਨੇ ਮੈਨੂੰ ਸੁਝਾਓ ਦਿੱਤਾ ਕਿ ਮੈਂ ਇੱਕ ਟੈਕਸੀ ਬੁੱਕ ਕਰ ਲਵਾਂ ਔਨਲਾਈਨ ਫਿਰ ਮੈਂ ਇੱਕ ਐਪ ਖੋਲ ਕੇ ਉਹਦੇ ਵਿੱਚ ਇੱਕ ਟੈਕਸੀ ਔਡਰ ਕੀਤੀ ਟੈਕਸੀ ਬੁੱਕ ਕੀਤੀ ਜਿਸ ਵਿੱਚ ਉਸਨੂੰ ਮੈਂ ਪੰਦਰਾਂ ਮਿੰਟ ਬਾਅਦ ਉਹ ਟੈਕਸੀ ਮੇਰੇ ਕੋਲ ਆ ਗਈ ਮੇਰੇ ਘਰ ਦੇ ਮੇਰੇ ਨਾਲ ਕੋਨਫਰੈਂਸ ਕੋਲ ਨਾਲ ਜੁੜੇ ਹੋਏ ਸੀ ਉਹ ਸਭ ਕੁਛ ਸੁਣ ਰਹੇ ਸੀ ਅਤੇ ਮੇਰੀ ਹਾਲਤ ਵੇਖ ਕੇ ਉਬਰ ਵਾਲਾ ਸਮਝ ਗਿਆ ਕਿ ਮੈਂ ਬਹੁਤ ਹੀ ਡਰਿਆ ਹੋਇਆ ਹਾਂ ਕਿਉਂਕਿ ਰਾਤ ਬਹੁਤ ਹੋ ਚੁੱਕੀ ਸੀ ਅਤੇ ਕੁਛ ਵੀ ਗਲਤ ਹੋ ਸਕਦਾ ਸੀ ਪਰ ਤਾਂ ਵੀ ਉਸ ਨੇ ਮੈਨੂੰ ਸਮਝਾਇਆ ਕਿ ਸਾਡੇ ਇੱਥੇ ਕੈਮਰਾ ਲੱਗਿਆ ਹੋਇਆ ਹੈ ਅਸੀਂ ਕੁਛ ਵੀ ਇੱਦਾਂ ਗਲਤ ਨਹੀਂ ਕਰ ਸਕਦੇ ਹਾਂ ਅਤੇ ਉਸ ਨੇ ਮੈਨੂੰ ਇੱਕ ਪਾਣੀ ਦੀ ਬੋਤਲ ਦਿੱਤੀ ਜਿਸ ਵਿੱਚ ਮੈਂ ਪਾਣੀ ਪੀਤਾ ਥੋੜ੍ਹਾ ਜਿਹਾ ਮੈਨੂੰ ਰਾਹਤ ਆਈ ਅਤੇ ਉਸ ਨੇ ਫਿਰ ਮੈਨੂੰ ਮੇਰੀ ਜਾਣ ਦੀ ਜਗ੍ਹਾ ਪੁੱਛੀ ਮੈਂ ਉਸ ਨੂੰ ਆਪਣੀ ਜਗ੍ਹਾ ਦੱਸੀ ਉਸ ਤੋਂ ਬਾਅਦ ਉਹ ਮੈਨੂੰ ਮੇਰੇੇ ਘਰ ਲਿਜਾ ਕ ਕੇ ਛੱਡ ਕੇ ਆਇਆ